ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਸੈਂਟ ਜੌਸਫ ਸਕੂਲ ਤੋਂ ਐੱਲ ਕੇ ਜੀ ਦੇ ਇੰਚਾਰਜ ਬੋਲਦੇ ਪਏ ਹਰਵੰਤ ਸਰ ਸਰ ਮੈਂ ਮਨਰੀਤ ਦੇ ਮੰਮਾ ਬੋਲਦੀ ਪਈ ਹਾਂ ਤੁਹਾਡੇ ਤੋਂ ਹੀ ਪੜ੍ਹਦਾ ਸਟੂਡੈਂਟ ਹੈ ਅਤੇ ਸਰ ਸਾਨੂੰ ਨਾ ਦਸ ਕੁ ਦਿਨ ਦੀ ਲੀਵ ਚਾਹੀਦੀ ਸੀ ਸਾਡੇ ਨਾ ਮੈਰਿਜ ਫੰਕਸ਼ਨ ਹੈਗਾ ਆ ਰੈਲਟਿਵਸ ਦੇ ਵਿੱਚ ਅਤੇ ਸਾਨੂੰ ਦਸ ਦਿਨ ਦੀ ਲੀਵ ਚਾਹੀਦੀ ਆ ਅਸੀਂ ਰਾਜਸਥਾਨ ਜਾਣਾ ਹੈਗਾ ਹਾਂਜੀ ਨਹੀ ਸਰ ਮਿਹਨਤ ਪੂਰੀ ਕਰਵਾਈ ਦੀ ਆ ਅਤੇ ਪਰ ਨਹੀਂ ਸਾਨੂੰ ਜਾਣਾ ਜ਼ਰੂਰੀ ਹੈਗਾ ਉੱਥੇ ਹਾਂਜੀ ਨਹੀਂ ਸਾਡੇ ਕਲੋਜ ਹੈਗੇ ਆ ਬਹੁਤ ਰੈਲੇਟਿਵਸ ਸਾਨੂੰ ਅਸੀਂ ਦੇਖੋ ਹੁਣ ਛੋਟਾ ਬੱਚਾ ਆ ਅਸੀਂ ਕਿਹਦੇ ਕੋਲ ਇਹਨੂੰ ਇੱਥੇ ਛੱਡ ਕੇ ਜਾਵਾਂਗੇ ਅਤੇ ਵਧੇਗੀ ਨਾ ਛੁੱਟੀ ਇੰਨੀ ਮਿਲੇਗੀ ਹਾਂਜੀ ਹਾਂ ਤੁਸੀਂ ਕੋਈ ਨਹੀਂ ਸਰ ਜੋ ਵੀ ਕਲਾਸ ਦੇ ਵਿੱਚ ਕੰਮ ਕਰਵਾਉਂਗੇ ਸਾਨੂੰ ਭੇਜ ਦਿਆ ਕਰਿਓ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਬੱਚੇ ਨੂੰ ਉੱਥੇ ਵੀ ਕਰਵਾਉਣ ਦੀ ਕੰਮ ਹਾਂਜੀ ਠੀਕ ਹੈ ਸਰ ਓਕੇ ਥੈਂਕ ਯੂ